ਸਤਿ ਸ਼੍ਰੀ ਅਕਾਲ ਜੀ ਫਲਿਪਕਾਰਟ ਤੋਂ ਬੋਲ ਰਹੇ ਹੈ ਅਸੀਂ ਦੋ ਮਹੀਨੇ ਪਹਿਲਾਂ ਤੁਹਾਡੇ ਤੋਂ ਏਸੀ ਲਿਆ ਸੀ ਹਟੈਚੀ ਕੰਪਨੀ ਦਾ ਡੇਢ ਟਨ ਬਹੁਤ ਹੀ ਪ੍ਰੌਬਲਮ ਆਈ ਸਾਨੂੰ ਰੇਟ ਤੁਸੀਂ ਬਹੁਤ ਜ਼ਿਆਦਾ ਲਗਾ ਦਿੱਤਾ ਬਜ਼ਾਰ ਨਾਲ ਤੋਂ ਵੀ ਅੱਠ ਹਜ਼ਾਰ ਰੁਪਏ ਦਾ ਫ਼ਰਕ ਸੀ ਅਤੇ ਪੈਕਿੰਗ ਸਾਰੀ ਫਟੀ ਵੀ ਮਿਲੀ ਭਿੱਜਿਆ ਵਾ ਗੱਤਾ ਸੀ ਇੱਕ ਪੱਖਾ ਵੀ ਟੁੱਟਿਆ ਸੀ ਬਿਜਲੀ ਬਹੁਤ ਜ਼ਿਆਦਾ ਖਾਂਦਾ ਇਹ ਠੰਡਾ ਕਰਦਾ ਹੀ ਨਹੀਂ ਦੋ ਘੰਟੇ ਲਗਾ ਦਿੰਦਾ ਠੰਡਾ ਕਰਨ ਨੂੰ ਅਤੇ ਇਹ ਤਾਂ ਬਹੁਤ ਚੀਜ਼ ਬੇਕਾਰ ਨਿਕਲੀ ਅਸੀਂ ਗਾਹਾਂ ਨੂੰ ਤੁਹਾਡੇ ਤੋਂ ਬਿਲਕੁਲ ਕੋਈ ਆਰਡਰ ਨਹੀਂ ਕਰਨਾ ਕਿਉੰਕਿ ਇਹ ਸਾਨੂੰ ਬਿਲਕੁਲ ਤੁਹਾਡੀ ਸਰਵਿਸ ਬੇਕਾਰ ਲੱਗੀ